ਮੈਂ ਨਵਾਂ ਸ਼ਹਿਰ ਸ਼ਹਿਰ ਵਿੱਚ ਰਹਿੰਦੀ ਹਾਂ ਅਤੇ ਮੰ ਇੱਥੇ ਮੌਸਮ ਨਾ ਠ ਜ਼ਿਆਦਾ ਠੰਡਾ ਰਹਿੰਦਾ ਹੈ ਅਤੇ ਨਾ ਜ਼ਿਆਦਾ ਗਰਮ ਰਹਿੰਦਾ ਹੈ ਬਹੁਤ ਹੀ ਵਧੀਆ ਰਹਿੰਦਾ ਹੈ ਅਤੇ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਕਹਿੰਦੀ ਹਾਂ ਕਿ ਇੱਥੇ ਆ ਕੇ ਘੁੰਮਣ ਫਿਰਨ ਅਤੇ ਇਸ ਨ ਮੈਂ ਕਹਿੰਦੀ ਉਹਨਾਂ ਨੂੰ ਕਿ ਇੱਕ ਨਵੰਬਰ ਤੋਂ ਲੈ ਕੇ ਦਸੰਬਰ ਦੇ ਮਹੀਨੇ ਵਿੱਚ ਆਉਣ ਅਤੇ ਵਧੀਆ ਜਗ੍ਹਾ 'ਤੇ ਘੁੰਮਣ ਅਤੇ ਇਹ ਇਹਨਾਂ ਦਿਨਾਂ ਦੇ ਵਿੱਚ ਤਿਉਹਾਰ ਆਉਂਦੇ ਹੈ ਦੀਵਾਲੀ ਹੋ ਗਈ ਗੁਰੂ ਨਾਨਕ ਦੇਵ ਜੀ ਦਾ ਬਰਡੇ ਆਉਣਾ ਮਤਲਬ ਬਹੁਤ ਵਧੀਆ ਤਰੀਕੇ ਨਾਲ਼ ਮਨਾਉਂਦੇ ਹੈ ਅਤੇ ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਜਿਵੇਂ ਕਿ ਅਸੀਂ ਦੀਵਾਲੀ ਮਨਾ ਕੇ ਹਟੇ ਹਾਂ ਬਹੁਤ ਵਧੀਆ ਮਨਾਈ ਅਸੀਂ ਨਾ ਜ਼ਿਆਦਾ ਠੰਡ ਸੀ ਨਾ ਜ਼ਿਆਦਾ ਗਰਮ ਸੀ ਅਤੇ ਮਤਲਬ ਮਨਾਉਣ 'ਚ ਵੀ ਬ ਬਹੁਤ ਵਧੀਆ ਲੱਗਿਆ ਅਤੇ ਮੈਂ ਕਹਿੰਦੀ ਹਾਂ ਕਿ ਮੈਂ ਇੱਥੇ ਆ ਕੇ ਉਹ ਘੁੰਮਣ ਫਿਰਨ ਬਹੁਤ ਵਧੀਆ ਲੱਗਦਾ ਹੈ ਇੱਥੇ ਘੁੰਮਣ ਫਿਰਨ 'ਚ ਅਤੇ ਇੱਥੇ ਬਹੁਤ ਜ਼ਿਆ ਸਾਰੇ ਜਗ੍ਹਾ ਵੀ ਹੁੰਦੇ ਹੈ ਘੁੰਮਣ ਫਿਰਨ ਵਾਲੇ ਅਤੇ ਮੈਂ ਕਹਿੰਦੀ ਹਾਂ ਉਹਨਾਂ ਨੂੰ ਕਿ ਆ ਕੇ ਇੱਥੇ ਘੁੰਮ ਫਿਰ ਕੇ ਇੱਕ ਵਾਰ ਜਾਣ ਇੱਕ ਵਾਰ ਦੇਖਣ ਇੱਥੇ ਦਾ ਮੌਸਮ ਤਾਂ ਉਹਨਾਂ ਨੂੰ ਪਤਾ ਲੱਗਣਾ ਕਿ ਉੱਥੇ ਦਾ ਮੌਸਮ ਅਤੇ ਇੱਥੇ ਦਾ ਮੌਸਮ ਦਾ ਕਿਆ ਅੰਤਰ ਹੁੰਦਾ ਹੈ